ਭਾਰਤ ਵਿੱਚ ਕਾਫੀ ਵਿਗਿਆਨੀਆਂ ਨੇ ਜਨਮ ਲਿਆ ਅਤੇ ਉਹਨਾਂ ਨੇ ਨਵੀਆਂ ਨਵੀਆਂ ਖੋਜਾਂ ਵੀ ਕੀਤੀਆਂ ਸਨ ਮੈਂ ਆਪਣੇ ਸਕੂਲ ਦੇ ਸਮੇਂ ਵਿੱਚ ਜਿਹੜੇ ਭਾਰਤੀ ਵਿਗਿਆਨੀਆਂ ਬਾਰੇ ਪੜ੍ਹਿਆ ਸਨ ਕਾਫੀ ਭਾਰਤੀ ਵਿਗਿਆਨੀਆਂ ਬਾਰੇ ਪੜ੍ਹਿਆ ਸਨ ਉਹਨਾਂ ਵਿੱਚੋਂ ਮੈਨੂੰ ਦੋ ਹਜੇ ਵੀ ਯਾਦ ਸਨ ਡੌਕਟਰ ਏਪੀਜੇ ਅਬਦੁਲ ਕਲਾਮ ਡੌਕਟਰ ਏਪੀਜੇ ਅਬਦੁਲ ਕਲਾਮ ਉਹ ਇੱਕ ਐਰੋਸਪੇਸ ਸਾਇੰਟਿਸਟ ਵੀ ਸੀ ਅਤੇ ਉਹਨਾਂ ਨੂੰ ਮਿਸਾਈਲ ਮੈਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ ਅਤੇ ਏਪੀਜੇ ਅਬਦੁਲ ਕਲਾਮ ਭਾਰਤ ਦੇ ਜਿਹੜੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਸੀ ਦੋ ਹਜ਼ਾਰ ਦੋ ਤੋਂ ਦੋ ਹਜ਼ਾਰ ਸੱਤ ਦੇ ਵਿੱਚ ਇਹਨਾਂ ਨੇ ਭਾਰਤ ਦੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਅਤੇ ਦੂਸਰੇ ਬਾਰੇ ਜਿਹੜੇ ਮੈਂ ਪੜ੍ਹਿਆ ਸੀ ਉਹ ਸੀ ਆਰਿਆ ਭੱਟ ਉਹ ਇੱਕ ਐਸਟਰੋਲੋਜਰ ਸੀ ਅਤੇ ਫਾਦਰ ਔਫ ਇੰਡੀਅਨ ਮੈਥੀਮਟੀਸ਼ੀਅਨ ਸੀ ਅਤੇ ਇਹਨਾਂ ਨੇ ਮੈਥ ਨੂੰ ਕਾਫੀ ਆਸਾਨ ਬਣਾਇਆ ਅਤੇ ਮੈਥ ਦੇ ਵਿੱਚ ਕਾਫੀ ਨਵੇਂ ਨਵੇਂ ਫੋਰਮੂਲਿਆਂ ਦੀ ਖੋਜ ਕੀਤੀ ਅਤੇ ਅਸੀਂ ਅੱਜ ਵੀ ਇਹਨਾਂ ਦੇ ਫੋਰਮੂਲੇ ਪੜ੍ਹਦੇ ਸਨ